ਭਾਰਤ ਇੱਕ ਸਭਿਆਚਾਰਕ ਦੇਸ਼ ਹੈ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜਿਵੇਂ ਕਿ ਹਿੰਦੂ ਮੁਸਲਿਮ ਸਿੱਖ ਇਸਾਈ ਜੈਨ ਅਤੇ ਬੁੱਧੀਜ਼ਮ ਵਾਲੇ ਹਰ ਧਰਮ ਦੀ ਆਪਣੀ ਪਰੰਪਰਾ ਅਤੇ ਆਪਣੇ ਵਿਸ਼ਵਾਸ ਹਨ ਕਿਸੇ ਵੀ ਧਰਮ ਦੀ ਪਰੰਪਰਾ ਅਤੇ ਵਿਸ਼ਵਾਸ ਕਿਸੇ ਦੂਸਰੇ ਧਰਮ ਦੀ ਪਰੰਪਰਾ ਅਤੇ ਵਿਸ਼ਵਾਸ ਤੋਂ ਪ੍ਰਮੁੱਖ ਜਾਂ ਘੱਟ ਨਹੀਂ ਹਨ ਦੂਸਰਾ ਇੱਥੇ ਵੱਖ ਵੱਖ ਬੋਲੀ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਹਨ ਦੁਨੀਆਂ ਦੇ ਵਿੱਚ ਤੁਹਾਨੂੰ ਸ਼ਾਇਰ ਦੀ ਕੋਈ ਹੋਰ ਦੇਸ਼ ਐਸਾ ਮਿਲੇਗਾ ਜਿੱਥੇ ਇੰਨੀਆਂ ਬੋਲੀਆਂ ਬੋਲੀਆਂ ਜਾਂਦੀਆਂ ਹੋਣ ਹਰ ਵੀਹ ਤੋਂ ਤੀਹ ਕਿਲੋਮੀਟਰ ਦੇ ਦਾਇਰੇ ਵਿੱਚ ਬੋਲੀ ਦਾ ਫਰਕ ਪੈ ਜਾਂਦਾ ਹੈ ਤੀਸਰਾ ਇੱਥੇ ਵੱਖ ਵੱਖ ਭੇਸ਼ ਭੂਸ਼ਾ ਵਾਲੇ ਲੋਕ ਰਹਿੰਦੇ ਹਨ ਵੱਖ ਵੱਖ ਭੇਸ਼ ਭੂਸ਼ਾ ਅਤੇ ਵੱਖ ਵੱਖ ਪਹਿਨਾਵੇ ਵਾਲੇ ਲੋਕ ਰਹਿੰਦੇ ਹਨ ਹਰ ਧਰਮ ਦਾ ਆਪਣਾ ਇੱਕ ਪਹਿਰਾਵਾ ਹੈ ਆਪਣੀ ਇਕ ਵੇਸ਼ਭੂਸ਼ਾ ਹੈ ਇੰਨਾ ਅੰਤਰ ਹੋਣ ਦੇ ਬਾਵਜੂਦ ਵੀ ਇੱਥੇ ਲੋਕ ਬਹੁਤ ਪਿਆਰ ਨਾਲ ਅਤੇ ਰਲ ਕੇ ਰਹਿੰਦੇ ਹਨ